ਸਾਡੇ ਖੇਤਰ ਦੇ ਹਸਪਤਾਲਾਂ ਵਿੱਚ ਬਿਸਤਰੇ ਆਕਸੀਜਨ ਸਿਲੰਡਰ ਸਿਰਜੀਕਲ ਔਜ਼ਾਰ ਬਹੁਤ ਹੀ ਲੋੜੀਂਦੇ ਹਨ ਹਾਂਜੀ ਬਹੁਤ ਵਧੀਆ ਸਾਡਾ ਹੋਸਪੀਟਲ ਹੈ ਇੱਥੇ ਬਿਸਤਰੇ ਵੀ ਮਿਲ ਜਾਂਦੇ ਹਨ ਮੰਜੇ ਡੋਕਟਰ ਸਹੀ ਟਾਈਮ 'ਤੇ ਮਿਲਦੇ ਹਨ ਪਰ ਸਾਡੇ ਨਾਲ ਇੱਕ ਘਟਨਾ ਹੋਈ ਕਿ ਮੇਰੀ ਬੇਟੀ ਬਿਮਾਰ ਸੀ ਅਸੀਂ ਹੋਸਪੀਟਲ ਗਏ ਸਾਨੂੰ ਉਸੇ ਟਾਈਮ ਕੋਈ ਬੈੱਡ ਨਹੀਂ ਮਿਲਿਆ ਅਤੇ ਡੋਕਟਰ ਨੇ ਐਡਮਿਟ ਵੀ ਨਹੀਂ ਕੀਤਾ ਹੈਗਾ ਸਾਨੂੰ ਬਹੁਤ ਮੁਸ਼ਕਿਲ ਆਈ ਉੱਥੇ ਬੇਟੀ ਨੂੰ ਆਕਸੀਜਨ ਲਾਉਣੀ ਸੀ ਨਾ ਉੱਥੇ ਸਿਲੰਡਰ ਮਿਲਿਆ ਨਾ ਬੈੱਡ ਮਿਲਿਆ ਸਾਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਾਂ ਜੀ